ਵਿਗਿਆਨੀਆਂ ਦੇ ਅਨੁਸਾਰ ਮੈਨੂੰ ਲੱਗਦਾ ਹੈ ਕਿ ਬ੍ਰਹਿਮੰਡ 'ਤੇ ਮੰਗਲ ਗ੍ਰਹਿ ਦੇ ਉੱਤੇ ਜੀਵਨ ਸੰਭਵ ਹੈ ਕਿਉਂਕਿ ਦੇਖਿਆ ਜਾਵੇ ਤਾਂ ਮੰਗਲ ਗ੍ਰਹਿ ਦੇ ਉੱਤੇ ਵੀ ਪਾਣੀ ਵੀ ਕਾਫੀ ਮਾਤਰਾ ਵਿੱਚ ਉਪਲੱਬਧ ਹੈ ਪਰ ਇੱਥੇ ਹੋਰ ਕਈ ਕੁਦਰਤੀ ਚੀਜ਼ਾਂ ਦੇ ਨਾ ਹੋਣ ਦੇ ਕਾਰਨ ਮੰਗਲ ਗ੍ਰਹਿ 'ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਵੇਖਿਆ ਜਾਵੇ ਤਾਂ ਚੰਦਰਮਾ ਦੇ ਉੱਤੇ ਵੀ ਚੰਦ ਦੇ ਉੱਤੇ ਵੀ ਜੀਵਨ ਸੰਭਵ ਹੋ ਸਕਿਆ ਸੀ ਪਰ ਸੂਰਜ ਦੀ ਰੌਸ਼ਨੀ ਨਾ ਹੋਣ ਹੋਣ ਦੇ ਕਾਰਨ ਚੰਦਰਮਾ ਬਿਲਕੁਲ ਠੰਡਾ ਹੈ ਜਿਸ ਕਾਰਨ ਉੱਥੇ ਪੌਦੇ ਵੀ ਉੱਗ ਨਹੀਂ ਸਕਦੇ ਅਤੇ ਸੂਰਜ ਦੀ ਰੌਸ਼ਨੀ ਤੋਂ ਬਿਨ੍ਹਾਂ ਉੱਥੇ ਜੀਵਨ ਸੰਭਵ ਨਹੀਂ ਹੋ ਸਕਦਾ